ਜਿਵੇਂ ਕਿ ਸਾਡੇ ਬਠਿੰਡੇ ਘੁੰਮਣ ਆਉਣਾ ਹੋਵੇ ਜੱਟਾਂ ਨੇ ਘਰ ਆਪਣੇ ਗੈਸਟ ਹਾਊਸ ਬਣਾਏ ਹੋਏ ਆ ਹਵੇਲੀਆਂ 'ਚ ਅਤੇ ਵਧੀਆ ਅਤੇ ਨਾਲੇ ਤਾਂ ਇੱਥੋਂ ਦਾ ਮਤਲਬ ਕਲਚਰ ਵੇਖਣ ਨੂੰ ਵਧੀਆ ਮਿਲਦਾ ਗਾ ਵੈਲ ਵਗੈਰਾ ਸਾਰਾ ਕੁਛ ਵਧੀਆ ਅਤੇ ਬਾਕੀ ਪਹਿਲੀ ਗੱਲ ਜਿਹੜੀ ਮਤਲਬ ਪ੍ਰੋਬਲਮ ਆਉਂਦੀ ਆ ਥੋੜ੍ਹੀ ਜਿਹੜੀ ਮਤਲਬ ਪੜ੍ਹਾਈ ਦੀ ਉਹਦੀ ਆਉਂਦੀ ਆ ਆਪਣੇ ਵੀ ਓ ਭਾਸ਼ਾ ਦੀ ਪ੍ਰੋਬਲਮ ਪੈਂਦੀ ਆ ਇੱਧਰ ਸਾਡੇ ਪਿਓਰ ਪੰਜਾਬੀ ਬੋਲਦੇ ਆ ਅਤੇ ਉਹਨਾਂ ਨੂੰ ਮਤਲਬ ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਇਸ ਕਰਕੇ ਇਹਦੀ ਪ੍ਰੋਬਲਮ ਪੈਂਦੀ ਆ ਕਿ ਊਂ ਬਾਕੀ ਸਾਰੇ ਵਧੀਆ ਸਾਡੇ ਠੀਕ ਠਾਕ ਥੈਂਕ ਯੂ ਜੀ